ਸਤਿ ਸ਼੍ਰੀ ਅਕਾਲ ਜੀ ਮੈਂ ਰਿਤਿਕਾ ਗੱਲ ਕਰ ਰਹੀ ਹਾਂ ਮੈਂ ਤੁਹਾਡੀ ਵੈੱਬਸਾਈਟ ਤੋਂ ਇੱਕ ਸ਼ੈਂਪੂ ਔਡਰ ਕਰਿਆ ਸੀ

ਪਰ ਮੈਨੂੰ ਇਸਦੀ ਡਿਲੀਵਰੀ ਬਹੁਤ ਹੀ ਲੇਟ ਰਿਸੀਵ ਹੋਈ ਹੈ ਇਸਦੀ ਪੈਕਿੰਗ ਵੀ ਬਹੁਤ ਮੈਸੀ ਸੀ ਜਿਸ ਇਸ ਸ਼ੈਂਪੂ ਦੇ ਨਾਲ ਮੇਰੇ ਹੇਅਰ ਫੋਲ ਬਹੁਤ ਜ਼ਿਆਦਾ ਹੋਣ ਲੱਗ ਗਿਆ ਹੈ ਅਤੇ ਮੇਰੇ ਹੇਅਰਸ ਵੀ ਬਹੁਤ ਜ਼ਿਆਦਾ ਡੈਮੇਜ ਹੋ ਗਏ ਹਨ ਇਸਦੀ ਐਕਸਪਾਇਰੀ ਡੇਟ ਬਹੁਤ ਹੀ ਜ਼ਿਆਦਾ ਨੇੜੇ ਸੀ ਜਿਸ ਮੇਰੇ ਵਾਲਾਂ 'ਚ ਡੈਂਡਰੋਫ ਵੀ ਬਹੁਤ ਜ਼ਿਆਦਾ ਹੋਣ ਲੱਗ ਗਿਆ ਹੈ ਇਸ ਸ਼ੈਂਪੂ ਦੇ ਕਾਰਨ ਹੀ ਸਿਰ ਵਾਲਾਂ 'ਚ ਸਿਰ 'ਚ ਡਰਾਇਨੈਂਸ ਬਹੁਤ ਹੋ ਗਈ ਹੈ ਮੈਂ ਔਡਰ ਕੀਤਾ ਸੀ ਅਨੀਅਨ ਫਲੇਵਰ ਬਟ ਮੈਨੂੰ ਉਹ ਰਿਸੀਵ ਨਹੀਂ ਹੋਇਆ ਅਤੇ ਮੈਂ ਕਹਿਣਾ ਚਾਹੁੰਦੀ ਹਾਂ ਅੱਗੇ ਤੋਂ ਮੈਂ ਇਹ ਔਡ ਮੈਂ ਕਦੇ ਤੁਹਾਡੀ ਵੈਬਸਾਈਟ ਤੋਂ ਔਡਰ ਨਹੀਂ ਕਰਾਂਗੀ ਨਾ ਹੀ ਅੱਗੇ ਕਿਸੇ ਆਪਣੇ ਸਰਕਲ 'ਚ ਦੱਸਾਂਗੀ ਔਡਰ ਕਰਨ ਲਈ ਬਹੁਤ ਹੀ ਬੇਕਾਰ ਸਰਵਿਸ ਮੈਨੂੰ ਮਿਲੀ ਹੈ ਅਤੇ ਮੈਂ ਇਸ ਸਰਵਿਸ ਤੋਂ ਬਿਲਕੁਲ ਵੀ ਖੁਸ਼ ਨਹੀਂ ਹਾਂ ਮੈਂ ਚਾਹੁੰਦੀ ਹਾਂ ਮੇਰੇ ਜਿੰਨੇ ਵੀ ਪੈਸੇ ਸੀ ਉਹ ਸਾਰੇ ਮੈਨੂੰ ਰਿਫੰਡ ਕੀਤੇ ਜਾਣ ਇਹ ਔਡਰ ਬਹੁਤ ਹੀ ਬੇਕਾਰ ਗੰਦਾ ਰਿਸੀਵ ਹੋਇਆ ਹੈ ਮੈਨੂੰ ਅਤੇ ਮੈਂ ਇਹ ਚੀਜ਼ ਕਦੇ ਸੋਚੀ ਨਹੀਂ ਸੀ ਕਿ ਤੁਹਾਡੀ ਵੈੱਬਸਾਈਟ ਤੋਂ ਮੈਨੂੰ ਐਨਾ ਗੰਦਾ ਔਡਰ ਰਿਸੀਵ ਹੋਵੇਗਾ ਮੈਂ ਤੁਹਾਡੀ ਸਰਵਿਸ ਤੋਂ ਬਹੁਤ ਹੀ ਅਨਹੈਪੀ ਹਾਂ ਸਤਿ ਸ਼੍ਰੀ ਅਕਾਲ